ਫਤਿਹਗੜ੍ਹ ਜ਼ਿਲ੍ਹਾ ਇੱਕ ਬਹੁਤ ਹੀ ਵਧੀਆ ਪ੍ਰਫੁੱਲਿਤ ਖੇਤਰ ਹੈ ਇੱਥੇ ਦੇ ਜ਼ਿਆਦਾਤਰ ਲੋਕ ਕਿਸਾਨ ਹਨ ਇੱਥੇ ਦੀਆਂ ਮੁੱਖ ਫਸਲਾਂ ਆਲੂ ਮੱਕੀ ਕਣਕ ਝੋਨਾ ਜੋ ਕਿ ਬਹੁਤ ਮਾਤਰਾ ਵਿੱਚ ਪੈਦਾ ਹੁੰਦਾ ਹੈ ਜਦੋਂ ਇੱਥੋਂ ਦੇ ਲੋਕ ਹਰ ਤਰ੍ਹਾਂ ਦੀ ਖੇਤੀ ਦੇ ਸਾਧਨ ਇੱਥੋਂ ਦੇ ਲੋਕਾਂ ਕੋਲ ਹਰ ਤਰ੍ਹਾਂ ਦੇ ਖੇਤੀ ਦੇ ਸਾਧਨ ਹਨ ਲੋਕਾਂ ਕੋਲ ਮੱਝਾਂ ਗਾਵਾਂ ਬੱਕਰੀਆਂ ਰੱਖਦੇ ਹਨ ਦੁੱਧ ਡੇਅਰੀ ਵਿੱਚ ਪਾਉਂਦੇ ਹਨ ਅਤੇ ਜ਼ਮੀਨ ਪਾਣੀ ਦਾ ਪੱਧਰ ਵੀ ਜ਼ਿਆਦਾ ਨੀਵਾਂ ਨਹੀਂ ਹੈ ਲੋਕਾਂ ਨੇ ਮੋਟਰਾਂ ਅਤੇ ਨਹਿਰਾਂ ਦੇ ਨਾਲ਼ ਸਿੰਚਾਈ ਕਰਦੇ ਹਨ ਜ਼ਿਆਦਾ ਜ਼ਮੀਨਾਂ ਹੋਣ ਕਰਕੇ ਲੋਕ ਕੋਲ ਧਨ ਵੀ ਬਹੁਤ ਹੀ ਜ਼ਿਆਦਾ ਹੈ